ਵੈਸੇ ਤਾਂ ਮੇਰੇ ਜ਼ਿਲ੍ਹੇ ਵਿੱਚ ਬਹੁਤ ਸਾਰੇ ਉਦਯੋਗ ਹਨ ਪਰ ਅੰਬੂਜਾ ਸੀਮਿੰਟ ਇੱਥੇ ਸੀਮਿੰਟ ਬਣਾਇਆ ਜਾਂਦਾ ਹੈ ਸਵਰਾਜ ਮਾਜ਼ਦਾ ਇੱਥੇ ਗੱਡੀਆਂ ਦੇ ਪਾਰਟ ਬਣਾਏ ਜਾਂਦੇ ਹਨ ਰਣਵੈਕਸੀ ਇੱਥੇ ਦਵਾਈਆਂ ਅਤੇ ਕੈਪਸੂਲ ਤਿਆਰ ਕੀਤੇ ਜਾਂਦੇ ਹਨ ਡੀ ਸੀ ਐਮ ਵਿੱਚ ਮਕੈਨੀਕਲ ਪਾਰਟ ਬਣਦੇ ਹਨ ਅਤੇ ਅਲਕਮਿਸਟ ਇੱਥੇ ਮੁਰਗੇ ਦੀ ਸਪਲਾਈ ਕੀਤੀ ਜਾਂਦੀ ਹੈ